ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜ਼ਿਲ੍ਹਾ ਪਠਾਨਕੋਟ ਦੀ ਨਿਵਾਸੀ ਬੋਲ ਰਹੀ ਹਾਂ ਮੈਂ ਅੱਜ ਤੁਹਾਨੂੰ ਨਵੇਂ ਜਨਮੇ ਬੱਚੇ ਨੂੰ ਇੱਕ ਸਵੱਛ ਵਾਤਾਵਰਨ ਵਿੱਚ ਕਿਵੇਂ ਰੱਖ ਸਕਦੇ ਹਾਂ ਉਸ ਬਾਰੇ ਦੱਸਣ ਜਾ ਰਹੀ ਹਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਜਦੋਂ ਕੋਈ ਨਵਾਂ ਜੰਮਿਆ ਬੱਚਾ ਹੋਇਆ ਹੋਏ ਅਗਰ ਉਹ ਸਰਦੀਆਂ 'ਚ ਜੰਮਿਆ ਤਾਂ ਉਸਨੂੰ ਜਿੰਨੀ ਗਰਮੀ ਦੇ ਸਕਦੇ ਹੋ ਉੱਨੀ ਦੇਣੀ ਚਾਹੀਦੀ ਹੈ ਜਿਹਦੇ ਨਾਲ਼ ਉਹ ਬਿਮਾਰ ਨਹੀਂ ਹੋਵੇਗਾ ਨਾਲ਼ੇ ਸਾਨੂੰ ਬੱਚਿਆਂ ਦੇ ਆਲੇ ਦੁਆਲੇ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਗੰਦਗੀ ਵਗੈਰਾ ਤਾਂ ਨਹੀਂ ਜੇ ਹੈ ਤਾਂ ਟਾਈਮ ਟਾਈਮ ਟੂ ਟਾਈਮ ਸਿਰ ਸਾਫ਼ ਕਰਨੀ ਚਾਹੀਦੀ ਆ ਕਿਉਂਕਿ ਜੋ ਨਵਾਂ ਜੰਮਿਆ ਬੱਚਾ ਹੁੰਦਾ ਉਹ ਤਾਂ ਬੜਾ ਹੀ ਨਾਜ਼ੁਕ ਹੁੰਦਾ ਉਹਨਾਂ ਨੂੰ ਬਿਮਾਰੀ ਵੀ ਬੜੀ ਜਲਦੀ ਲੱਗ ਜਾਂਦੀ ਆ ਨਾਲ਼ ਜਦੋਂ ਬੱਚਾ ਨ ਨਵਾਂ ਜੰਮਿਆ ਹੁੰਦਾ ਤਾਂ ਸਾਨੂੰ ਉਸ ਦੇ ਕੱਪੜੇ ਵੀ ਟਾਈਮ ਟੂ ਟਾਈਮ ਬਦਲਣੇ ਚਾਹੀਦੇ ਆ ਕਿਉਂਕਿ ਬੱਚੇ ਉਲਟੀਆਂ ਕਰਦੇ ਆ ਵੋਸ਼ਰੂਮ ਵਗੈਰਾ ਕਰਦੇ ਆ ਜੋ ਕਿ ਅਗਰ ਸਮੇਂ ਤੋਂ ਸਮੇਂ ਬਦਲੇ ਨਹੀਂ ਜਾਣ ਤਾਂ ਬੱਚੇ ਬਿਮਾਰ ਹੋਣ ਦਾ ਡਰ ਹੁੰਦਾ ਮਤਲਬ ਬਹੁਤ ਸ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਬਾਕੀ ਤਾਂ ਸਾਨੂੰ ਵੀ ਸਲਾਹ ਦੇਵਾਂ ਬਾਕੀ ਤਾਂ ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗੀ ਕਿ ਸਾਰੇ ਬੱਚਿਆਂ ਦੇ ਚੰਗੀ ਤਰ੍ਹਾਂ ਧਿਆਨ ਰੱਖਣਾ ਕਿਉਂਕਿ ਬੱਚੇ ਬੜੀ ਜਲਦੀ ਬਿਮਾਰ ਹੋ ਜਾਂਦੇ ਆ ਉਹਨਾਂ ਦੀ ਸਾਫ਼ ਸਫ਼ਾਈ ਪੂਰੀ ਚੰਗੀ ਤਰੀਕੇ ਨਾਲ਼ ਰੱਖਣੀ ਚਾਹੀਦੀ ਹੈ ਉਹਨਾਂ ਨੂੰ ਹੈਂਡ ਵੋਸ਼ ਕਰਕੇ ਹਮੇਸ਼ਾਂ ਫੜਣਾ ਜਦੋਂ ਵੀ ਫੜਣਾ ਮਤਲਬ ਚੰਗੀ ਤਰ੍ਹਾਂ ਉਹਨਾਂ ਦੀ ਸਫ਼ਾਈ ਰੱਖਣੀ ਚਾਹੀਦੀ ਆ ਧੰਨਵਾਦ